ਹੈਲੋ ਹਾਂਜੀ ਫੋਲਨ ਬਸ ਸਰਵਿਸ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣੀ ਵੋਲਵੋ ਜੀ ਸਾਰੇ ਪੂਰੇ ਪੰਜਾਬ 'ਚ ਇੰਟਰ ਕਨੈਕਟਡ ਹੈ ਜੀ ਸਾਰੇ ਪਾਸੇ ਜਾਂਦੀਆਂ ਨੇ ਹਰੇਕ ਸ਼ਹਿਰ 'ਚ ਜਾਂਦੀਆਂ ਨੇ ਜੀ ਬਟ ਜਿਹੜੀ ਮੇਜਰ ਸੀਟੀਸ 'ਚ ਜਾਣ ਜਿਹੜੀ ਮੇਜਰ ਸੀਟੀਸ 'ਚ ਜਾਂਦੀਆਂ ਨੇ ਉਹ ਆਪਣਾ ਨੌ ਸੌ ਕ ਹੁੰਦੀਆਂ ਨੇ ਜੀ ਜਿਵੇਂ ਜਲੰਧਰ ਅੰਮ੍ਰਿਤਸਰ ਵੱਡੀਆਂ ਸੀਟੀਸ ਹਾਂਜੀ ਹਾਂਜੀ ਹਾਂਜੀ ਵੋਲਵੋ ਦੀਆਂ ਬੱਸਾਂ ਬਿਨ੍ਹਾਂ ਏਸੀ ਤੋਂ ਹੋ ਹੀ ਨਹੀਂ ਸਕਦੀਆਂ ਜੀ ਸਾਰੀਆਂ ਏਸੀ ਬੱਸਾਂ ਨੇ ਜੀ ਕੰਫਰਟੇਬਲ ਸੀਟਸ ਹੋਣਗੀਆਂ ਜੀ ਸਾਰਾ ਕੁਛ ਹੋਵੇਗਾ ਦੂਰ ਸੀਟੀਸ ਕਿੰਨੀ ਕੁ ਦੂਰ ਜੀ ਢਾਈ ਸੌ ਕਰਾ ਦਾਂਗੇ ਜੀ ਹੋਰ ਹੈਗੀ ਆ ਜੀ ਬੱਸ ਆਪਣੇ ਕੋਲ ਏ ਟਰਿਪ ਤੁਹਾਡਾ ਡਿਪੈਂਡ ਕਰਦਾ ਜੀ ਤੁਹਾਡਾ ਸ਼ਹਿਰ ਕਿਹੜਾ ਵਾ ਰੂਟ 'ਤੇ ਡਿਪੈਂਡ ਕਰਦਾ ਨਾ ਉਹ ਹਾਂਜੀ ਜੀ ਹਾਊਸ ਵਾਈਸ ਫੁਲ ਆ ਜੀ ਸਾਡਾ ਪੂਰਾ ਸਟਾਫ ਖਿਆਲ ਰੱਖਦਾ ਜੀ

ਹਾਂਜੀ ਉਹ ਫਿਰ ਤੁਹਾਨੂੰ ਲੱਗ ਤੋਂ ਪੈਕੇਜ ਲੈਣਾ ਪਊਗਾ ਜੀ ਦੇਖੋ ਉੱਦਾਂ ਤਾਂ ਬਸ ਦੇ ਤਾਂ ਮ ਤਲਬ ਸਟੋਪਸ ਹੁੰਦੇ ਨੇ ਹੈ ਨਾ ਵੀ ਤੁਸੀਂ ਜੇ ਕਿਸੇ ਸਾਰੇ ਪਸੈਂਜਰਸ ਨੇ ਕੁਛ ਖਾਣਾ ਪੀਣਾ ਹੈ ਨਾ ਬਟ ਇੱਕ ਜੇ ਸਵੇਰੇ ਤੁਸੀਂ ਚਾਹੁੰਦੇ ਹੋ ਤਾਂ ਸਵੇਰੇ ਅਸੀਂ ਤੁਹਾਨੂੰ ਕਰਾ ਸਕਦੇ ਹਾਂ ਆਪਣਾ ਪ੍ਰੋਵਾਈਡ ਟਰੰਚ ਕਰਾ ਸਕਦੇ ਜੀ ਇੱਕ ਹਜ਼ਾਰ ਤਾਂ ਪਰ ਜਾਵੇਗਾ ਹਾਂਜੀ ਹਾਂਜੀ ਹਾਂਜੀ ਜੀ ਪੂਰੀਆਂ ਪੂਰੀਆਂ ਹੀ ਖੁੱਲਦੀਆਂ ਪੂਰੀਆਂ ਖੁੱਲ੍ਹੀਆਂ ਜੀ ਪੂਰੀਆਂ ਖੁੱਲ੍ਹੀਆਂ ਨੇ ਜੀ ਵੋਲਵੋ ਦੀ ਬੱਸ 'ਤੇ ਕੋਈ ਹੈ ਹੀ ਨਹੀਂ

ਨਹੀਂ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੀ ਚੰਡੀਗੜ੍ਹ ਤੱਕ ਜੀ ਹਾਂਜੀ ਹਾਂਜੀ ਹਾਂਜੀ ਹੈਗੇ ਆ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਪਰ ਸਾਡਾ ਇੱਦਾਂ ਹੈਗਾ ਜੀ ਸਾਡੀ ਕੋਈ ਵੀ ਟਿਕਟ ਨਾ ਜਿਵੇਂ ਤੁਸੀਂ ਜਾਂਦੇ ਹੋ ਬਾਹਰ ਵੀ ਉਨੇ ਦਾ ਕੰਫਰਟੇਬਲ ਬੱਸਾਂ ਅਤੇ ਪੈਕੇਜ ਪਾ ਕੇ ਜੀ ਹਲਕੀ ਚਾਹੇ ਭਾਰੀ ਤੇਰ੍ਹਾਂ ਸੌ ਰੁਪਇਆ ਸਵਾਰੀ ਹਾਂਜੀ ਹਾਂਜੀ ਹਾਂਜੀ ਇਹ ਮਤਲਬ ਜੇ ਤੁਸੀਂ ਦਿੱਲੀ ਜਿੰਨਾ ਟਰੈਵਲ ਕਰਨਾ ਤਾਂ ਜੀ

ਹਾਂਜੀ ਬਸ ਜੀ ਓਕੇ ਜੀ ਓਕੇ ਠੀਕ ਹੈ ਜ਼ਰੂਰ ਜੀ